ਮੈਨੂੰ ਜਦੋਂ ਵੀ ਸਮਾਂ ਲੱਗਦਾ ਹੈ ਉਦੋਂ ਮੈਂ ਅਖਬਾਰ ਤੋਂ ਖਬਰਾਂ ਪੜ੍ਹਦੀ ਹਾਂ ਜਾਂ ਟੀਵੀ 'ਤੇ ਕਈ ਚੈਨਲਾਂ ਤੋਂ ਖਬਰਾਂ ਸੁਣਦੀ ਹਾਂ ਇਹ ਮੇਰਾ ਕੋਈ ਪੱਕਾ ਸਮਾਂ ਨਹੀਂ ਹੈ ਕਿ ਮੈਂ ਕਦੋਂ ਖਬਰਾਂ ਸੁਣਨੀਆਂ ਹਨ ਮੈਨੂੰ ਖੇਡਾਂ ਮਨੋਰੰਜਨ ਵਿਗਿਆਨ ਅਤੇ ਸਿੱਖਿਆ ਦੀਆਂ ਖਬਰਾਂ ਸੁਣਨੀਆਂ ਜ਼ਿਆਦਾ ਪਸੰਦ ਹਨ ਖੇਡਾਂ ਵਿੱਚ ਮੈਨੂੰ ਕ੍ਰਿਕਟ ਖੇਡ ਬਹੁਤ ਚੰਗੀ ਲੱਗਦੀ ਹੈ ਅਤੇ ਮਨੋਰੰਜਨ ਵਿੱਚ ਮੈਨੂੰ ਪੰਜਾਬੀ ਮਨੋਰੰਜਨ ਨਾਲ ਜੁੜੀਆਂ ਖਬਰਾਂ ਚੰਗੀਆਂ ਲੱਗਦੀਆਂ ਹਨ ਵਿਗਿਆਨ ਦੇ ਖ ਖੇਤਰ ਵਿੱਚ ਜੋ ਜੋ ਨਵੀਆਂ ਖੋਜਾਂ ਹੋ ਰਹੀਆਂ ਹਨ ਉਸ ਨਾਲ ਜੁੜੀਆਂ ਖਬਰਾਂ ਨਾਲ ਆਪਣੀ ਜੋ ਨੋਲੇਜ ਹੈ ਉਸ ਵਿੱਚ ਵਾਧਾ ਹੁੰਦਾ ਹੈ ਅਤੇ ਸਿੱਖਿਆ ਦੇ ਖੇਤਰ ਵਿੱਚ ਸਿੱਖਿਆ ਵਿੱਚ ਕੀ ਕੁਝ ਨਵਾਂ ਚੱਲ ਰਿਹਾ ਹੈ ਉਸ ਦੇ ਨਾਲ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਅਤੇ ਇਸ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਅਸੀਂ ਆਪਣੇ ਬੱਚਿਆਂ ਲਈ ਵੀ ਸਿੱਖਿਆ ਦੇ ਖੇਤਰ ਵਿੱਚ ਕੀ ਨਵਾਂ ਸੋਚ ਸਕਦੇ ਹਾਂ ਜਿਸ ਦੇ ਨਾਲ ਉਹਨਾਂ ਨੂੰ ਰੁਜ਼ਗਾਰ ਮਿਲੇ ਜਾਂ ਉਹ ਆਪਣੇ ਪੈਰਾਂ 'ਤੇ ਕਿਸ ਤਰੀਕੇ ਨਾਲ ਖੜ੍ਹੇ ਹੋ ਸਕਦੇ ਹਨ